ਜੀ ਹਾਂ ਮੈਂ ਬਿਜਲੀ ਦੇ ਖਤਰਿਆਂ ਤੋਂ ਜਾਣੂ ਹਾਂ ਬਿਜਲੀ ਨਾਲ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ ਇੰਜੀਨੀਅਰ ਇਲੈਕਟਰੀਸ਼ੀਅਨ ਅਤੇ ਹੋਰ ਕਰਮਚਾਰੀ ਸਿੱਧੇ ਤੌਰ 'ਤੇ ਬਿਜਲੀ ਨਾਲ ਨਜਿੱਠਦੇ ਹਨ ਜਿਸ ਵਿੱਚ ਓਵਰਹੈਡ ਲਾਈਨਾਂ ਇਲੈਕਟਰੀਕਲ ਸੰਸਥਾਪਨਾ ਸਰਕਿਟ ਅਸੈਂਬਲੀ ਅਤੇ ਆਦਿ ਹੋਰ ਕੰਮ ਸ਼ਾਮਿਲ ਹਨ ਹੋਰ ਜਿਵੇਂ ਕਿ ਦਫ਼ਤਰੀ ਕਰਮਚਾਰੀ ਕਿਸਾਨ ਅਤੇ ਉਸਾਰੀ ਕਾਮੇ ਜਿਵੇਂ ਕਿ ਮਿਸਤਰੀ ਅਤੇ ਮਜ਼ਦੂਰ ਇਹ ਵੀ ਅਸਿੱਧੇ ਤੌਰ 'ਤੇ ਬਿਜਲੀ ਨਾਲ ਕੰਮ ਕਰਦੇ ਹੀ ਰਹਿੰਦੇ ਹਨ ਅਤੇ ਬਿਜਲੀ ਦੇ ਖਤਰਿਆਂ ਦਾ ਸਾਹਮਣਾ ਵੀ ਕਰਦੇ ਹਨ ਕੁਝ ਇਹੋ ਜਿਹੇ ਬਿਜਲੀ ਤੋਂ ਮਿਲਣ ਵਾਲੇ ਖਤਰੇ ਹਨ ਜਿਵੇਂ ਬਿਜਲੀ ਦਾ ਝਟਕਾ ਅਤੇ ਲਾਈਵ ਪਾਰਟਸ ਦੇ ਸੰਪਰਕ ਦਾ ਸੜਨਾ ਬਿਜਲੀ ਦੇ ਉਪਕਰਨਾਂ ਤੋਂ ਅੱਗ ਲੱਗਣੀ ਅਨਉਚਿਤ ਬਿਜਲੀ ਉਪਕਰਨ ਦੇ ਕਾਰਨ ਵਿਸਫੋਟ ਹੋ ਜਾਣੇ ਇਨ੍ਹਾਂ ਖਤਰਿਆਂ ਤੋਂ ਨਜਿੱਠਣ ਲਈ ਕੁਝ ਤਰੀਕੇ ਹਨ ਜਿਵੇਂ ਕਿ ਡਿੱਗੀ ਹੋਈ ਪਾਵਰ ਲਾਈਨ ਨੂੰ ਕਦੇ ਨਾ ਛੂਹੋ ਡਿੱਗੀਆਂ ਪਾਵਰ ਲਾਈਨਾਂ ਦੀ ਰਿਪੋਰਟ ਕਰਨ ਲਈ ਪਾਵਰ ਕੰਪਨੀ ਨੂੰ ਕਾਲ ਕਰੋ ਸਫ਼ਾਈ ਅਤੇ ਹੋਰ ਗਤੀਵਿਧੀਆਂ ਦੌਰਾਨ ਓਵਰਹੈਡ ਪਾਵਰ ਲਾਈਨਾਂ ਦੇ ਸੰਪਰਕ ਤੋਂ ਬਚੋ ਜੇਕਰ ਡਿੱਗੀਆਂ ਬਿਜਲੀ ਦੀਆਂ ਲਾਈਨਾਂ ਪਾਣੀ ਵਿੱਚ ਹਨ ਤਾਂ ਖੜ੍ਹੇ ਪਾਣੀ ਵਿੱਚੋਂ ਗੱਡੀ ਨਾ ਚਲਾਓ ਜੇਕਰ ਬਿਜਲੀ ਸਰਕਿਟ ਅਤੇ ਬਿਜਲੀ ਉਪਕਰਨ ਗਿੱਲੇ ਹੋ ਗਏ ਹਨ ਜਾਂ ਪਾਣੀ ਵਿੱਚ ਹਨ ਜਾਂ ਪਾਣੀ ਦੇ ਨੇੜੇ ਹਨ ਤਾਂ ਸਰਵਿਸ ਪੈਨਲ ਜਾਂ ਮੇਨ ਸਰਕਿਟ ਫਿਊਜ਼ ਦਾ ਪਾਵਰ ਬੰਦ ਕਰ ਦਿਓ ਮੁੱਖ ਪਾਵਰ ਬੰਦ ਕਰਨ ਦੇ ਨਾਲ ਇਸ ਤੋਂ ਖਤਰਾ ਬਚ ਜਾਂਦਾ ਹੈ ਇਸ ਨੂੰ ਬੰਦ ਕਰਨ ਲਈ ਇੱਕ ਇਲੈਕਟਰੀਸ਼ਨ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਕਦੇ ਵੀ ਆਪਣੇ ਆਪ ਨੂੰ ਪਾਵਰ ਚਾਲੂ ਜਾਂ ਬੰਦ ਨਾ ਕਰੋ ਜਾਂ ਪਾਣੀ ਵਿੱਚ ਖੜੇ ਹੋਣ ਵੇਲੇ ਕਿਸੇ ਇਲੈਕਟਰਿਕ ਟੂਲ ਜਾਂ ਕਿਸੇ ਇਲੈਕਟ੍ਰਿਕ ਉਪਕਰਨ ਦੀ ਵਰਤੋਂ ਨਾ ਕਰੋ ਜੇਕਰ ਤੁਸੀਂ ਬਿਜਲੀ ਨੂੰ ਬਹਾਲ ਕਰਦੇ ਸਮੇਂ ਟੁੱਟੀਆਂ ਤਾਰਾਂ ਜਾਂ ਚੰਗਿਆੜੀਆਂ ਦੇਖਦੇ ਹੋ ਜਾਂ ਤੁਹਾਨੂੰ ਕਿਸੇ ਚੀਜ਼ ਦੇ ਬਲਨ ਦੀ ਬਦਬੂ ਆਉਂਦੀ ਹੈ ਪਰ ਕੋਈ ਅੱਗ ਨਹੀਂ ਦਿਖਾਈ ਦੇ ਰਹੀ ਤਾਂ ਬਿਜਲੀ ਸਿਸਟਮ ਨੂੰ ਤੁਰੰਤ ਵਰ ਬੰਦ ਕਰ ਦੇਣਾ ਚਾਹੀਦਾ ਹੈ ਪਾਵਰ ਜਨਰੇਟਰਾਂ ਸਮੇਤ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਕਰਨ ਬਾਰੇ ਆਪਣੀ ਉਪਯੋਗਤਾ ਕੰਪਨੀ ਨਾਲ ਸਲਾਹ ਕਰੋ ਇਹ ਸਭ ਕੁਝ ਇਹੋ ਜਿਹੇ ਤਰੀਕੇ ਹਨ ਜਿਨ੍ਹਾਂ ਤੋਂ ਅਸੀਂ ਬਿਜਲੀ ਦੇ ਖਤਰਿਆਂ ਤੋਂ ਬਚ ਸਕਦੇ ਹਾਂ ਧੰਨਵਾਦ